ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਨੂੰ ਹੁਣੇ ਪਤਾ ਲੱਗਿਆ ਵੀ ਤੁ ਮੇਰਾ ਨਾਮ ਸੁਮਨਦੀਪ ਕੌਰ ਆ ਅਤੇ ਮੈਨੂੰ ਹੁਣ ਪਤਾ ਲੱਗਿਆ ਤੁਸੀਂ ਆ ਫਰੀਦਕੋਟ ਜ਼ਿਲ੍ਹੇ 'ਚ ਸ਼ਿਫਟ ਹੋਏ ਹੋ ਹੁਣੇ ਹੁਣੇ ਅਤੇ ਮੇਰੇ ਹਸਬੈਂਡ ਨਾ ਹੁਣੇ ਰਿਟਾਇਰ ਹੋਏ ਆ ਅਤੇ ਮਤਲਬ ਉਹ ਕਾ ਮੈਂ ਫਿਰ ਇਕੱਲੀ ਘਰ ਰਹਿ ਜਾਂਦੀ ਹਾਂ ਅਤੇ ਤੁਸੀਂ ਮੈਨੂੰ ਇੱਥੇ ਇੱਥੋਂ ਦੇ ਹਿਸਟੋਰੀਕਲ ਬਾਰੇ ਦੱਸ ਦਿਓ ਕੁਛ ਹਾਂਜੀ ਹਾਂਜੀ ਹਾਂਜੀ ਅੱਛਾ ਹਾਂਜੀ

ਠੀਕ ਹੈ ਜੀ ਗੋਦੜੀ ਸਾਹਿਬ ਬਾਰੇ ਦੱਸੋ ਤੁਸੀਂ ਹਿਸਟਰੀ ਕੁਝ ਹਾਂਜੀ ਠੀਕ ਹੈ ਜੀ ਹੁਣ ਮੈਂ ਇੱਥੇ ਇਸ ਜਗ੍ਹਾ 'ਤੇ ਜ਼ਰੂਰ ਜਾਊਂਗੀ ਤੁਸੀਂ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਿ ਯੂ ਓਕੇ ਬਾਏ